ਸਭ ਤੋਂ ਪਹਿਲਾਂ ਤਾਂ ਤੈਨੂੰ ਬਹੁਤ ਬਹੁਤ ਵਧਾਈ ਕਿ ਤੈਨੂੰ ਨਵੀਂ ਨੌਕਰੀ ਮਿਲੀ ਹੈ ਦੂਸਰਾ ਮੈਨੂੰ ਬਹੁਤ ਚੰਗਾ ਲੱਗਿਆ ਕਿ ਤੂੰ ਇੱਕ ਸਿਹਤ ਬੀਮਾ ਖਰੀਦਣਾ ਚਾਹੁੰਦਾ ਹੈ ਸਿਹਤ ਬੀਮਾ ਖਰੀਦਣ ਤੋਂ ਪਹਿਲਾਂ ਤੈਨੂੰ ਉਸ ਕੰਪਨੀ ਬਾਰੇ ਪੂਰੀ ਜਾਣਕਾਰੀ ਹੋਣੀ ਚਾਹੀਦੀ ਹੈ ਤੂੰ ਕਿੰਨੇ ਦਾ ਬੀਮਾ ਖਰੀਦਣਾ ਚਾਹੁੰਦਾ ਹੈ ਕਿੰਨਾ ਵੇਟਿੰਗ ਪੀਰੀਅਡ ਟਾਈਮ ਹੈ ਹੋਸਪੀਟਲ ਤੋਂ ਪਹਿਲਾਂ ਅਤੇ ਬਾਅਦ ਵਿੱਚ ਕਿੰਨਾ ਭੁਗਤਾਨ ਹੈ ਸਾਰੀਆਂ ਬਿਮਾਰੀਆਂ ਅਤੇ ਉਨ੍ਹਾਂ ਦੇ ਇਲਾਜ ਵਿੱਚ ਜੋ ਵੀ ਰੂਲਜ਼ ਰੈਗੂਲੇਸ਼ਨਸ ਦੀ ਜਾਣਕਾਰੀ ਜ਼ਰੂਰੀ ਹੈ ਕਿੰਨੇ ਹਸਪਤਾਲ ਉਸ ਮੈਡੀਕਲ ਪੋਲਿਸੀ ਦੇ ਥੱਲੇ ਆਉਂਦੇ ਹਨ ਪ੍ਰੀਮੀਅਮ ਦੀ ਕਿੰਨੀ ਰਕਮ ਹੋਵੇਗੀ ਕੈਸ਼ ਬਿਨਾਂ ਨਕਦੀ ਤੋਂ ਭੁਗਤਾਨ ਦੀ ਵਿਵਸਥਾ ਅਤੇ ਫਲੈਕਸੀਵਲ ਭੁਗਤਾਨ ਵਿਕਲਪ ਬਾਰੇ ਸਾਰੀ ਜਾਣਕਾਰੀ ਤੇਰੇ ਕੋਲ ਹੋਣੀ ਚਾਹੀਦੀ ਹੈ ਅੱਜ ਦੇ ਸਮੇਂ ਵਿੱਚ ਮੈਡੀਕਲ ਇੰਸ਼ੋਰੈਂਸ ਦਾ ਹੋਣਾ ਬਹੁਤ ਜ਼ਰੂਰੀ ਹੈ